ਖੇਡਾਂ ਖੇਡਣ ਨਾਲ ਪੇਂਡੂ ਖੇਤਰ ਦੇ ਲੋਕਾਂ ਵਿੱਚ ਆਪਸੀ ਭਾਈਚਾਰਾ ਵੱਧਦਾ ਆਪਸੀ ਪਿਆਰ ਵੱਧਦਾ ਅੱਜ ਕੱਲ੍ਹ ਅਗਰ ਦੇਖਿਆ ਜਾਵੇ ਤਾਂ ਇਹ ਜਿਹੜੀਆਂ ਖੇਡਾਂ ਏ ਉਹ ਅਲੋਪ ਹੀ ਹੁੰਦੀਆਂ ਜਾਂਦੀਆਂ ਅਲੋਪ ਹੀ ਹੁੰਦੀਆਂ ਜਾ ਰਹੀਆਂ ਇਹਨਾਂ ਚੀਜ਼ਾਂ ਜਾਂ ਇਹਨਾਂ ਖੇਡਾਂ ਦੀ ਜਿਹੜੀ ਜਗ੍ਹਾ ਹੈ ਉਹ ਹੁਣ ਸਟੇਡੀਅਮ ਬਣ ਗਏ ਉਹ ਵੀ ਬਾਹਰ ਆਪਾਂ ਸ਼ਹਿਰਾਂ ਵੱਲ ਨੂੰ ਜ਼ਿਆਦਾ ਭੱਜਣ ਲੱਗ ਪਏ ਪਿੰਡਾਂ ਦੇ ਲੋਕਾਂ ਦਾ ਜਿਹੜਾ ਆਪਸੀ ਪਿਆਰ ਹੈ ਵੈਸੇ ਵੀ ਬਣਿਆ ਰਹਿੰਦਾ ਹੈ ਬਟ ਜਦੋਂ ਖੇਡਾਂ ਹੁੰਦੀਆਂ ਤਾਂ ਉਹ ਇੱਕ ਦੂਜੇ ਦੇ ਸੰਪਰਕ ਵਿੱਚ ਆਉਂਦੇ ਬਹੁਤ ਸਾਰੇ ਲੋਕ ਆਪਸ ਵਿੱਚ ਇਕੱਠੇ ਹੁੰਦੇ ਹੈ ਆਪਸੀ ਗੱਲਬਾਤ ਕਰਦੇ ਹੈ ਆਪਣੇ ਵਿਊਜ਼ ਦਿੰਦੇ ਹੈ ਖੇਡ ਦੇ ਰਿਗਾਡਿੰਗ ਇਸ ਤਰ੍ਹਾਂ ਲੋਕਾਂ ਵਿੱਚ ਭਾਈਚਾਰਾ ਵੀ ਵੱਧਦਾ